ਪੰਜਾਬ ਸਿਆਸੀ ਪਾਰਟੀਆਂ ਨੇ ਜਿਵੇਂ ਹਾਊਸ ਵਿਡੋ ਡੋਰ ਮਤਲਬ ਓਪਨ ਕੀਤਾ ਉਹਨਾਂ ਲਈ ਕੀ ਹੈ ਸ਼ਪੈਸ਼ਲ ਕੀ ਉਹਨਾਂ ਦੇ ਬੱਚਿਆਂ ਲਈ ਜਿਵੇਂ ਜਿਹੜੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਦੀ ਪੈਨਸ਼ਨ ਅਤੇ ਉਹਨਾਂ ਦੇ ਮਤਲਬ ਵੀਡੋਜ਼ ਦੀ ਪੈਨਸ਼ਨ ਸਕੀਮ ਜਿਹੜੀ ਉਹ ਸਟਾਰਟ ਕੀਤੀ ਹੈ ਜਿਹਦੇ ਨਾਲ਼ ਕੀ ਹੈ ਉਹ ਆਪਣੀ ਜ਼ਿੰਦਗੀ ਨੂੰ ਕੀ ਹੈ ਸੌਖੇ ਢੰਗ ਨਾਲ ਥੋੜ੍ਹੇ ਸੌਖੇ ਢੰਗ ਨਾਲ ਕੀ ਹੈ ਚਲਾ ਸਕਣ ਉਸੇ ਤਰ੍ਹਾਂ ਕੀ ਆ ਜਿਹੜੇ ਬਜ਼ੁਰਗ ਪੈਨਸ਼ਨ ਮਤਲਬ ਬੁਢਾਪਾ ਪੈਨਸ਼ਨ ਜਿਹੜੀ ਆ ਉਹ ਵੀ ਚਾਲੂ ਕੀਤੀ ਹੈ ਜਿਹੜੇ ਬਜ਼ੁਰਗਾਂ ਨੂੰ ਮਤਲਬ ਘਰ ਦੇ ਮਤਲਬ ਉਹਨਾਂ ਦੇ ਬੱਚੇ ਨਕਾਰ ਦਿੰਦੇ ਨੇ ਤਾਂ ਉਹ ਆਪਣੇ ਇਸ ਪੈਨਸ਼ਨ ਦੇ ਥਰੂ ਆਪਣੀ ਕੀ ਆ ਜ਼ਿੰਦਗੀ ਨੂੰ ਜਿਹੜੀ ਉਹ ਚਲਾ ਸਕਦੇ ਨੇ ਇਸ ਤਰ੍ਹਾਂ ਮਤਲਬ ਬੋ ਹੈਲਥ ਨੂੰ ਲੈ ਕੇ ਮਤਲਬ ਸਰਕਾਰ ਨੇ ਵੀ ਬਹੁਤ ਮਤਲਬ ਵਧੀਆ ਕਦਮ ਚੁੱਕੇ ਨੇ ਜਿਹਦੇ ਨਾਲ ਕੀ ਹੈ ਇੱਕ ਆਮ ਆਦਮੀ ਆ ਜਿਹੜਾ ਉਹ ਕੀ ਆ ਆਪਣੀ ਸੈਤ ਸ਼ੇਤ ਇਸ਼ੂ ਨੂੰ ਸੋਲਵ ਕਰ ਸਕਦਾ ਏ ਇਸੇ ਤਰ੍ਹਾਂ ਬਹੁਤ ਸਾਰੇ ਮਤਲਬ ਕਿ ਸਟੈਪ ਚੁੱਕੇ ਗਏ ਨੇ ਜਿਹੜੇ ਕਿ ਆ ਆਮ ਲੋਕਾਂ ਲਈ ਬਹੁਤ ਵਧੀਆ ਸਾਬਤ ਹੋਏ ਨੇ